ਹੈਲੋ ਹਾਂਜੀ ਸਰ ਹਾਂਜੀ ਸਰ ਹਾਂਜੀ ਸਰ ਹਾਂਜੀ ਸਰ ਜਿਵੇਂ ਕਿ ਹਨਾ ਆਪਣੇ ਪੰਜਾਬ 'ਚ ਵੱਧ ਫਸਲਾਂ ਤਾਂ ਕਣਕ ਤਾਂ ਝੋਨੇ ਦੀਆਂ ਲੱਗਦੀਆਂ ਨੇ ਕਿਉਂਕਿ ਇਹ ਬਦ ਇਹਦਾ ਆਪਾ ਨੂੰ ਵੱਧ ਲੋੜ ਹੁੰਦੀ ਇਸ ਲਈ ਤਾਂ ਇਹ ਮਤਲਬ ਫਸਲਾ ਪਾਣੀ ਵੀ ਬਹੁਤ ਲੈਂਦੀਆਂ ਨੇ ਜਦੋਂ ਆਪਾਂ ਇਹਨਾਂ ਨੂੰ ਪਾਣੀ ਲਗਾਉਣੇ ਆ ਤਾਂ ਆਪਾਂ ਨੂੰ ਹਨਾ ਉਹ ਘੱਟ ਫਸਲਾਂ ਉਹ ਵੀ ਜਨ ਕਹਿ ਰਹੇ ਸੀ ਤੇ ਘੱਟ ਪਾਣੀ ਵੇਸਟ ਹੋਵੇ ਕਿਉਂਕਿ ਪਾਣੀ ਮਤਲਬ ਆਪਣੇ ਜੀਵਨ ਲਈ ਬਹੁਤ ਜਰੂਰੀ ਆ ਇਹਨੂੰ ਆਪਾਂ ਐਵੇਂ ਵੇਸਟ ਨਹੀਂ ਕਰ ਸਕਦੇ ਹਨਾ ਹਾਂਜੀ ਤੇ ਮਤਲਬ ਜਿਵੇਂ ਕਿ ਹੋਰ ਆਪਾਂ ਹੋਰ ਕਈ ਫਸਲਾਂ ਜਿਵੇਂ ਸਬਜ਼ੀਆਂ ਉਗਾਉਨੇ ਆ ਭਿੰਡੀ ਤੋਰੀਆ ਕੱਦੂ ਹਨਾ ਇਹਨਾ ਇਹਨਾਂ ਦੀ ਵੀ ਪੈਦਾਵਾਰ ਵਧੀਆ ਹੁੰਦੀ ਹ ਸਾਡੇ ਕੋਲੇ ਤੁਸੀਂ ਜੋ ਵੀ ਸਬ ਮਤਲਬ ਕੋਈ ਵੀ ਸਬਜੀ ਦਾ ਬੀਜ ਲੈਣਾ ਹੋਵੇ ਜਾਂ ਕਣਕ ਝੋਨਾ ਜੋ ਵੀ ਜਿਹਦਾ ਬੀਜ ਲੈਣਾ ਹੋਵੇ ਤੁਸੀਂ ਸਾਡੇ ਨਾਲ ਸੰਪ ਸੰਪਰਕ ਕਰ ਸਕਦੇ ਹੋ ਬੀਜ ਲਈ ਹਾਂਜੀ ਜੋ ਵੀ ਮਤਲਬ ਅਸੀਂ ਤੁਹਾਨੂੰ ਉਹਦੇ ਚ ਦੱਸਾਂਗੇ ਮੈਨੂੰ ਕੌਣ ਵਧੀਆ ਬੀਜ ਆ ਕਿਹੜਾ ਨਹੀਂ ਹਾਂਜੀ ਤਾਂ ਕਰਕੇ ਮਤਲਬ ਤੁਸੀਂ ਜਦੋਂ ਤੁਸੀਂ ਸਾਡੇ ਨਾਲ ਮਤਲਬ ਅਸੀਂ ਨਾ ਮਸੂਰੀ ਕਰਦੇ ਹੀ ਰਹਿੰਦੇ ਆ ਬੀਜਾਂ ਦੀ ਵੀ ਜੋ ਕੀ ਸਭ ਤੋਂ ਵਧੀਆ ਕੁਆਲਿਟੀ ਦਾ ਬੀਜ ਹੁੰਦਾ ਸੀ ਉਹਨੂੰ ਅਸੀਂ ਅੱਗੇ ਲਿਆਉਣੇ ਆ ਹਾਂਜੀ ਸਰ ਬਾਕੀ ਸਰ ਆਹੀ ਮਤਲਬ ਜਿਆਦਾ ਸਾਰਾ ਆਪਣੇ ਪੰਜਾਬ 'ਚ ਕਣਕ ਤੇ ਝੋਨਾ ਹੀ ਉਗਾਇਆ ਜਾਂਦਾ ਕਿਉਂਕਿ ਆਪ ਨੂੰ ਕਣਕ ਦਾ ਹਾਂ ਆਪਾਂ ਕਿਉਂਕਿ ਆਪ ਨੂੰ ਕਣਕ ਦਾ ਬਹੁਤ ਜਰੂਰਤ ਹੁੰਦੀ ਆ ਆਪਣੇ ਇਹਦੇ ਵਿੱਚ ਲਾਈਫ ਵਿੱਚ ਇਸ ਕਰਕੇ ਮਤਲਬ ਇਹ ਵਧੀਆ ਸਭ ਤੋਂ ਉੱਤਮ ਫਸਲ ਆ ਨਾਲੇ ਹਾਂਜੀ ਸਰ ਮੈਂ ਆ ਕਰ ਸਕਦੀ ਆ ਥੋਡੀ ਈਮੇਲ ਤੇ ਤੁਸੀਂ ਹਨਾ ਸਾਡੇ ਨਾਲ ਕੁਝ ਵੀ ਸੰਪਰਕ ਕਰ ਸਕਦੇ ਹੋ ਜੋ ਵੀ ਤੁਹਾਨੂੰ ਤੁਸੀਂ ਬੀਜ ਚਾਹੀਦਾ ਜੋ ਵੀ ਜਿਦਾਂ ਫਲ ਫਲ ਸਬਜ਼ੀਆਂ ਜਿਸਦਾ ਵੀ ਚਾਹੀਦਾ ਤੁਸੀਂ ਸਾਡੇ ਨਾਲ ਆ ਕੇ ਲੈ ਸਕਦੇ ਹੋ ਸਾਡੇ ਨਾਲ ਅਸੀਂ ਤੁਹਾਨੂੰ ਉਹਦੇ ਵਿੱਚ ਦੱਸਾਗੇ ਵੀ ਕਿਹੜਾ ਵਧੀਆ ਕੁਆਲਟੀ ਦਾ ਬੀਜ ਆ ਤੇ ਕਿਹੜਾ ਨਹੀਂ ਹਾਂਜੀ ਸਰ ਤੁਸੀਂ ਕਰ ਸਕਦੇ ਹੋ ਹਾਂਜੀ ਸਰ ਤੇ ਬਾਕੀ ਹਨਾ ਜੋ ਵੀ ਮਤਲਬ ਦੇਖੋ ਆ ਨਾ ਅੱਜ ਕੱਲ ਪਾਣੀ ਦੀ ਵੀ ਬਹੁਤ ਕਮੀ ਹੋ ਰਹੀ ਐ ਤਾਂ ਇਸ ਕਰਕੇ ਆਪਾਂ ਨੂੰ ਜਿਆਦਾਤਰ ਉਹ ਫਸਲਾਂ ਉਗਾਣੀ ਚਾਹੀਦੀ ਜਿਸ ਮਤਲਬ ਜਿਸ ਨਾਲ ਕੀ ਘੱਟ ਪਾਣੀ ਲੱਗਦਾ ਹੋਵੇ ਜਿਸ ਤੇ ਇਹ ਪਾਣੀ ਚ ਲਗਾਉਣਾ ਵੀ ਚਾਹੀਦਾ ਕਿਉਂਕਿ ਆਪਾਂ ਨੂੰ ਐਂ ਹੁੰਦਾ ਵੀ ਕਈ ਵਾਰ ਆਪਣੀ ਫਸਲ ਹਨਾ ਕੱਚੀ ਨਾ ਰਹਿ ਜਾਂ ਆਪਾ ਪਾਣੀ ਲਾਈਏ ਹਾਂਜੀ ਤਾਂ ਕਰਕੇ ਹੁਣ ਵੀ ਸਾਰੀਆਂ ਇਹਦੇ ਚ ਆਪਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜਦੋਂ ਆਪਾਂ ਫਸਲ ਉਗਾਉਣੇ ਆ ਕੋਈ ਹਾਂਜੀ ਸਰ ਥੈਂਕਯੂ ਜੀ ਸਰ